ਸਰਕਾਰੀ ਸੰਸਥਾਵਾਂ ਗੈਰ ਮੁਨਾਫਾ ਰਾਜ ਖੇਡ ਦੇ ਵਿਕਾਸ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੀਆਂ ਹਨ ਜਿਵੇਂ ਕਿ ਛੋਟੇ ਬੱਚੇ ਸਟਾਰਟਿੰਗ ਵਿੱਚ ਆਪਣੇ ਆਪ ਤਾਂ ਖੇਡਣਾ ਨਹੀਂ ਸਿੱਖਦੇ ਜਾਂ ਫਿਰ ਉਹਨਾਂ ਨੂੰ ਕਿਸੇ ਵੀ ਲੈਵਲ 'ਤੇ ਜਾਣ ਲਈ ਸੰਸਥਾਵਾਂ ਵਿੱਚ ਜਾਂ ਹੋਰ ਕੋਈ ਐ ਐਂਟਰ ਕਰਨਾ ਪੈਂਦਾ ਦਾਖਲ ਹੋਣਾ ਪੈਂਦਾ ਏ ਖੇਡ ਸੰਸਥਾਵਾਂ ਖਿਡਾਰੀ ਨੂੰ ਖੇਡ ਪ੍ਰਤੀ ਚੰਗੀ ਕੋਚਿੰਗ ਦਿੰਦੀਆਂ ਅਤੇ ਰਹਿਣ ਸਹਿਣ ਦਾ ਵੀ ਖਾਣ ਪੀਣ ਦਾ ਐਨ ਚੰਗਾ ਪ੍ਰਬੰਧ ਕਰਦੀਆਂ ਏ ਖੇਡ ਸੰਸਥਾਵਾਂ ਵਿੱਚ ਚੰਗੇ ਕੋਚ ਅਤੇ ਹੋਰ ਚੰਗੇ ਕੋਚਾਂ ਨਾਲ ਸੰਬੰਧ ਬਣਾ ਕੇ ਖਿਡਾਰੀ ਨੂੰ ਸਿਖਲਾਈ ਦਿੰਦੇ ਹਾਂ ਅਤੇ ਉਹਨਾਂ ਨੂੰ ਹੋਰ ਉੱਚ ਲੈਵਲ 'ਤੇ ਜਾਣ ਲਈ ਉਤਸ਼ਾਹਿਤ ਪ੍ਰੇਰਿਤ ਨੈਸ਼ਨਲ ਲੈਵਲ ਉਲੰਪਿਕ ਖੇਡਾਂ ਵਿੱਚ ਤੱਕ ਲਿਜਾਉਣ ਵਿੱਚ ਕੋਚਾਂ ਦਾ ਅਹਿਮ ਰੋਲ ਹੁੰਦਾ ਏ